ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਅਠਾਰ੍ਹਾਂ ਅਕਤੂਬਰ ਉੱਨੀ ਸੌ ਉਣਾਨਵੇਂ ਬਾਈ ਮਾਰਚ ਅਠਾਰ੍ਹਾਂ ਸੌ ਅਠਾਸੀ ਇੱਕੀ ਅਪ੍ਰੈਲ ਉੱਨੀ ਸੌ ਬਾਈ ਤੇਈ ਜਨਵਰੀ ਸਤਾਰ੍ਹਾਂ ਸੌ ਪੱਚੀ